ਜਦੋਂ ਤੋਂ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਮੈਂ ਆਪਣੇ ਆਪ ਵਿੱਚ ਸਭ ਤੋਂ ਡੂੰਗੀ ਤਬਦੀਲੀ ਇਹ ਮਹਿਸੂਸ ਕਰਦੀ ਹਾਂ ਕਿ ਮੈਂ ਸਰੀਰਕ ਪੱਖੋਂ ਬਹੁਤ ਹੀ ਤੰਦਰੁਸਤ ਹੋ ਗਈ ਹਾਂ ਅਤੇ ਦਿਮਾਗ਼ ਵਿੱਚ ਤੰਦਰੁਸਤੀ ਅਤੇ ਇਕਾਗਰਤਾ ਮਹਿਸੂਸ ਕਰਦੀ ਹਾਂ ਮੈਂ ਇਸ ਸਮੇਂ ਦੇ ਨਾਲ ਨਾਲ ਇਸ ਤਬਦੀਲੀ ਨੂੰ ਇਸ ਤਰ੍ਹਾਂ ਕਾਇਮ ਰੱਖਦੀ ਹਾਂ ਕਿ ਮੈਂ ਹਰ ਰੋਜ਼ ਦੋ ਘੰਟੇ ਯੋਗਾ ਅਤੇ ਨਾਲ ਨਾਲ ਸੈਰ ਕਰਦੀ ਹਾਂ ਇਸ ਦੇ ਨਾਲ ਮੈਂ ਬਹੁਤ ਹੀ ਵਧੀਆ ਫੀਲ ਕਰਦੀ ਹਾਂ ਮੇਰੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ ਮੇਰੀ ਸਰੀਰ ਬਹੁਤ ਲਚਕੀਲਾ ਮਹਿਸੂਸ ਕਰਦਾ ਹੈ ਅਤੇ ਸਮੇਂ ਦੇ ਨਾਲ ਨਾਲ ਮੈਂ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਇਕਾਗਰਤਾ ਮਹਿਸੂਸ ਕਰਦੀ ਹਾਂ ਮੇਰੀ ਪੜ੍ਹਾਈ ਦੇ ਨਾਲ ਨਾਲ ਮੈਂ ਮੇਰਾ ਦਿਮਾਗ਼ ਵੀ ਸ਼ਾਂਤ ਰਹਿੰਦਾ ਹੈ ਇਸ ਦੇ ਨਾਲ ਨਾਲ ਮੈਂ ਆਪਣੇ ਆਪ ਨੂੰ ਵੀ ਹੋਰ ਵਧੀਆ ਮਹਿਸੂਸ ਕਰਦੀ ਹਾਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਦੂਰ ਰੱਖਣ ਲਈ ਯੋਗਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲਈ ਯੋਗਾ ਦੇ ਨਾਲ ਨਾਲ ਮੈਂ ਸਰੀਰਕ ਲਚਕੀਲਾ ਮਹਿਸੂਸ ਹੁੰਦਾ ਹੈ ਅਤੇ ਮੇਰਾ ਉਸਦੇ ਨਾਲ ਵੇਟ ਵੀ ਘੱਟ ਰਿਹਾ ਹੈ